ਜਲੇਬੀ ਗੁਲਾਬ ਜਾਮਨ ਰਸਗੁੱਲਾ ਬਰਫੀ ਪਿੰਨੀ ਲੱਡੂ ਪਰਾਂਠਾ ਮਾਲ ਪੂਆ ਸੇਂਦੀ ਪੰਜੀਰੀ ਪੇੜਾ ਕਾਜੂ ਬਰਫੀ ਕਾਲਾ ਜਾਮੁਨ ਸੂਜੀ ਦਾ ਹਲਵਾ ਗਾਜਰ ਦਾ ਹਲਵਾ ਮੂੰਗ ਦਾਲ ਦਾ ਹਲਵਾ ਅੰਬ ਵਾਲੀ ਬਰਫੀ ਪਿਸਤਾ ਬਰਫੀ ਵੇਸਣ ਦਾ ਲੱਡੂ ਨਾਰੀਅਲ ਬਰਫੀ ਮੱਖਣ ਮਿਸ਼ਰੀ ਰਵੜੀ ਫੇਣੀ ਖੀਰ ਸੇਵੀਆਂ ਦੀ ਖੀਰ ਚਨੇ ਕੇ ਲੱਡੂ ਮਿਸ਼ਰੀ ਮਾਵਾ ਬਾਲੂ ਸ਼ਾਹੀ ਡੋਡਾ ਬਰਫੀ ਸੰਦੂਰ ਬਰਫੀ ਚੋਕੀ ਬਰਫੀ ਪਤ ਪਤੀਸਾ ਮਿਲਕ ਕੇਕ ਮਲਾਈ ਚਾਂਪ ਪੰਜੀਰੀ ਮਾਲਪੂਆ ਬੇਸਣ ਦੀ ਬਰਫੀ ਬਦਾਮ ਦੀ ਬਰਫੀ ਦੁੱਧ ਪਕੋਰੀ ਸੂਜੀ ਪਿੰਨੀ ਅੰਗੂਰੀ ਰਾਮ ਰਾਮ ਰਾਮਮਲਾਈ ਰਸਮਲਾਈ ਫਲੂਦਾ ਸੇਵੀਆ ਚੰਪਕਲੀ ਤਿਲ ਲੱਡੂ ਗੁੜ ਦੀ ਰੇਵੜੀ ਗੁੜ ਪੱਟੀ ਸੁੱਕੀ ਪਿੰਨੀ ਖਜੂਰ ਦੀ ਬਰਫੀ ਚੋਕੀ ਲੱਡੂ ਕੱਟ ਖੱਟੀ ਰੇਵੜੀ ਧੰਨਵਾਦ